ਜੀ ਮੈਂ ਜੀ ਮੈਂ ਸਰਦਾਰ ਨਛੱਤਰ ਸਿੰਘ ਬੋਲ ਰਿਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਸੀਂ ਵਕੀਲ ਬੋਲ ਰਹੇ ਹੋ ਜੀ ਮੈਂ ਮੇਰੇ ਦੋਸਤ ਨੇ ਸੁਜੈਸਟ ਕੀਤਾ ਸੀ ਤੁਹਾਡਾ ਨੰਬਰ ਕਹਿੰਦੇ ਕਾਫੀ ਵਧੀਆ ਵਕੀਲ ਨੇ ਉਹ ਮੇਰਾ ਕੇਸ ਇਸ ਸਿਲਸਿਲੇ ਬਾਰੇ ਹੈ ਕਿ ਮੇਰੇ ਨਾ ਚਾਰ ਪੁੱਤਰ ਨੇ ਮੈਂ ਉਹਨਾਂ ਦਾ ਨਾ ਜ਼ਮੀਨਾਂ ਵੰਡਣੀਆਂ ਉਹਨਾਂ ਨੇ ਚਾਰਾਂ ਦੇ ਹਿੱਸੇ 'ਚ ਤਾਂ ਉਹਦੇ ਵਾਸਤੇ ਤੁਹਾਡੇ ਤੋਂ ਬਣਵਾਉਣਾ ਵਾ ਜਿਹੜਾ ਹੁੰਦੀ ਨਹੀਂ ਉਹ ਹੀ ਕਹਿੰਦੇ ਉਹਨੂੰ ਤੁਹਾਨੂੰ ਤਾਂ ਪਤਾ ਹੀ ਹੋਣਾ ਜਿਹੜੀ ਕਾਗਜ਼ੀ ਲੈਂਗੁਏਜ ਹੈਗੀ ਮੈਨੂੰ ਉਹਦੇ ਬਾਰੇ ਨਾ ਜਾਣਬਾਜ ਨਹੀਂ ਹੈਗੀ ਅਤੇ ਉਹ ਕਰਣਾ ਵਾ ਤਾਂ ਉਹਦਾ ਦਸਤਾਵੇਜ਼ ਵਗੈਰਾ ਬਣਾਉਣਾ ਅਤੇ ਉਹਦਾ ਕੀ ਮਤਲਬ ਕੀ ਕਾਰਿਆਕਰਮ ਉਹਦਾ ਨਹੀਂ ਨਹੀਂ ਬਰਾਬਰ ਬਰਾਬਰ ਨਹੀਂ ਵੰਡਣੀ ਇੱਕ ਹੈਗਾ ਮੇਰਾ ਨਾ ਛੋਟਾ ਨਿਆਣਾ ਹੈਗਾ ਨਾ ਜਿਹੜਾ ਉਹ ਥੋੜ੍ਹਾ ਸ਼ੈਤਾਨ ਹੈ ਉਹਨੂੰ ਥੋੜ੍ਹੀ ਘੱਟ ਦੇਵਾਂਗੇ ਜੀ ਹਾਂ ਕਾਗਜ਼ ਪੂਰੇ ਲੱਭ ਨਹੀਂ ਰਹੇ ਕਿੱਥੇ ਰੱਖੇ ਵੇ ਆ ਹਾਂਜੀ ਹੋਰ ਕਿਸ ਚੀਜ਼ ਦੀ ਲੋੜ ਪਊਗੀ ਜੀ ਤੁਸੀਂ ਕੋਰਟ 'ਤੇ ਨਹੀਂ ਰਹਿੰਦੇ ਜੀ ਅੱਛਾ ਜੀ ਅਤੇ ਮਤਲਬ ਮੈਂ ਆਪਣੇ ਛੋਟੇ ਨਿਆਣੇ ਨੂੰ ਥੋੜ੍ਹੀ ਜਿਹੀ ਘੱਟ ਦੇਣੀ ਆ ਮੇਰੀ ਹੈਗੀ ਪੰਜ ਸੌ ਕਿੱਲਾ ਜ਼ਮੀਨ ਆ ਪੰਜ ਸੌ ਡਿਵਾਈਡ ਬਾਏ ਚਾਰ ਕਿੰਨਾ ਹੋ ਗਿਆ ਜੀ ਅੱਛਾ ਤਾਂ ਮਤਲਬ ਮੈਂ ਤੁਹਾਡੇ ਤੋਂ ਕਦੋਂ ਆ ਸਕਦਾ ਮਿਲਣ ਗੱਲ ਕਦੋਂ ਕਰ ਸਕਦਾਂ ਆ ਕੇ ਤੁਸੀਂ ਤਾਂ ਮਖੌਲ ਬੜਾ ਕਰਦੇ ਤੁਸੀਂ ਕਹਿੰਦੇ ਜਦੋਂ ਮਰਜ਼ੀ ਆ ਜਿਓ ਉਹ ਤਾਂ ਨੌਂ ਤੋਂ ਸ਼ਾਮ ਛੇ ਵਜੇ ਇੱਦਾਂ ਨਹੀਂ ਹੁੰਦਾ ਅੱਛਾ ਐਡਰੈਸ ਕੀ ਆਪਣਾ ਆਪੋਇੰਟਮੈਂਟ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਂ ਦੇ ਦਓ ਮੈਨੂੰ ਅਪੋਇਟਮੈਂਟ ਹਾਂ ਤਾਂ ਮਤਲਬ ਕਿਸੇ ਹੋਰ ਦਾ ਨੰਬਰ ਦੇ ਦਓ ਨਾ ਜਿੱਥੇ ਮੈਂ ਅਪੋਆਇੰਟਮੈਂਟ ਲੈਣੀ ਆ ਕਿ ਤੁਸੀਂ ਆਪੇ ਹੀ ਅਪੋਆਇੰਟਮੈਂਟ ਦੇ ਦਓਗੇ ਅੱਛਾ ਅੱਛਾ ਮਤਲਬ ਕਿੰਨੇ ਵਜੇ ਤੱਕ ਆ ਸਕਦਾ ਮੈਂ ਤੁਸੀਂ ਫਰੀ ਕਿਸ ਟਾਈਮ 'ਤੇ ਹੋਵੋਗੇ ਤਾਂ ਮਤਲਬ ਫੀਸ ਫੂਸ ਕਿੰਨੀ ਲਉਗੀ ਤੁਸੀਂ ਇਸ ਚੀਜ਼ ਦੀ ਦੇਖ ਤਾਂ ਲਵਾਂਗੇ ਦੱਸ ਤਾਂ ਦਓ ਮੈਨੂੰ ਜਿੰਨੇ ਮੈਂ ਦੇ ਸਕਦਾ ਮੈਂ ਤਾਂ ਫਿਰ ਮੈਂ ਆਸ਼ੀਰਵਾਦ ਹੀ ਦੇ ਸਕਦਾ ਆਪਣਾ ਮਤਲਬ ਮੇਰੇ ਕੋਲ ਦੇਣ ਨੂੰ ਤਾਂ ਜ਼ਿਆਦਾ ਕੁਝ ਹੈ ਨਹੀਂ ਮੁੰਡਿਆਂ ਨੂੰ ਦੇ ਦਿੱਤਾ ਨਾ ਪੰਜ ਸੌ ਕਿੱਲਾ ਤਾਂ ਬਚਿਆ ਹੀ ਕੀ ਮੇਰੇ ਕੋਲ ਫਿਰ ਤਾ ਉਹ ਹੀ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਮ ਮਖੌਲ ਕਰੀ ਜਾਂਦੇ ਹੋ ਫਿਰ ਤੋਂ ਅੱਛਾ ਚਲੋ ਜੀ ਫਿਰ ਮੈਂ ਤੁਹਾਡੇ ਤੋਂ ਮਿਲਣ ਆ ਜਾਂਦਾ ਕੱਲ੍ਹ ਠੀਕ ਹੈ ਜੀ ਸਤਿ ਸ਼੍ਰੀ ਅਕਾਲ